ਹਾਂ ਮੈਂ ਫੋਟੋਗ੍ਰਾਫੀ ਲਈ ਕਈ ਜਗਾਵਾਂ 'ਤੇ ਯਾਤਰਾ ਕੀਤੀ ਹੈ ਜਿੱਥੇ ਪਹਾੜ ਨਦੀਆਂ ਜੰਗਲ ਹੋਣ ਉੱਥੋਂ ਦਾ ਅਨੁਭਵ ਬਹੁਤ ਵਧੀਆ ਰਿਹਾ ਹੈ ਕਿਉਂਕਿ ਪਹਾੜਾਂ ਅਤੇ ਨਦੀਆਂ ਪੰਛੀਆਂ ਦੀਆਂ ਫੋਟੋਆਂ ਬਹੁਤ ਸੋਹਣੀਆਂ ਆਉਂਦੀਆਂ ਹਨ ਅਤੇ ਦਿਲ ਨੂੰ ਆਕਰਸ਼ਿਤ ਕਰਦੀਆਂ ਹਨ ਆਪਣੇ ਵੱਲ ਫੋਟੋਆਂ ਆਕਰਸ਼ਿਤ ਕਰਦੀਆਂ ਹਨ